ਪੰਜਾਬੀ ਭਾਸ਼ਾ ਗੁਰੂਆਂ ਪੀਰਾਂ ਦੀ ਦੇਣ ਹੈ ਸਾਡੇ ਮਹਾਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਲਿਪੀ ਵਿੱਚ ਹੀ ਹੈ ਗੁਰਮੁਖੀ ਲਿਪੀ ਵਿੱਚ ਸੋਧ ਤੋਂ ਬਾਅਦ ਪੈਂਤੀ ਅੱਖਰੀ ਆਈ ਸਾਡਾ ਪੰਜਾਬੀਆਂ ਦਾ ਬਹੁਤਾ ਇਤਿਹਾਸ ਗੁਰਮੁਖੀ ਲਿਪੀ ਵਿੱਚ ਸਾਂਭਿਆ ਗਿਆ ਇਹ ਇੱਕ ਮਿੱਠੀ ਅਤੇ ਜੋਸ਼ੀਲੀ ਭਾਸ਼ਾ ਆ ਜਿਸਨੂੰ ਵਿਸ਼ਵ ਪੱਧਰ 'ਤੇ ਵੀ ਪਹਿਚਾਣ ਮਿਲੀ ਹੋਈ ਹੈ ਅਤੇ ਸੰਸਾਰ ਵਿੱਚ ਸੱਤਵੇਂ ਨੰਬਰ 'ਤੇ ਆਉਂਦੀ ਹੈ ਇਹ ਭਾਸ਼ਾ ਵਿਕਾਸਸ਼ੀਲ ਦੇਸ਼ ਜਿਵੇਂ ਕਨੇਡਾ ਅਮੈਰੀਕਾ ਇੰਗਲੈਂਡ ਆਸਟ੍ਰੇਲੀਆ ਇਹਨਾਂ ਵਿੱਚ ਪੰਜਾਬੀ ਦੂਜੇ ਜਾਂ ਤੀਜੇ ਨ ਤੀਜੇ ਨੰਬਰ ਦੀ ਭਾਸ਼ਾ ਦਾ ਦਰਜਾ ਰੱਖਦੀ ਹੈ ਇਤਿਹਾਸ ਗਵਾਹ ਹੈ ਕਿ ਇਹ ਭਾਸ਼ਾ ਆਮ ਆਦਮੀ ਅੰਦਰ ਦੇਸ਼ ਭਗਤੀ ਦਾ ਜੋਸ਼ ਅਸ਼ ਅਤੇ ਜਨੂੰਨ ਭਰਦੀ ਆਈ ਆ ਪੰਜਾਬੀ ਭਾਸ਼ਾ ਵਿੱਚ ਬੋਲਿਆ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਅਰੇ ਨੇ ਕਈ ਆਜ਼ਾਦੀ ਦੀ ਲੜਾਈਆਂ ਸਾਨੂੰ ਜਿੱਤਵਾ ਜਿੱਤਾ ਦਿੱਤੀਆਂ ਹੈਗੀਆਂ ਸੋ ਸਾਡੀ ਇਹ ਭਾਸ਼ਾ ਬਹੁਤ ਮਹਾਨ ਭਾਸ਼ਾ ਆ ਬਹੁਤ ਅਮੀਰ ਭਾਸ਼ਾ ਆ